ਪੰਜਾਬੀ ਸੱਭਿਆਚਾਰ ਵਿੱਚ ਭੰਗੜੇ ਦੀ ਬਹੁਤ ਜ਼ਿਆਦਾ ਮਹੱਤਤਾ ਹੈ ਭੰਗੜਾ ਇੱਕ ਪੰਜਾਬੀਆਂ ਦਾ ਰੂਹ ਦੀ ਜਿਵੇਂ ਖੁਰਾਕ ਕਹਿ ਦਿੰਦੇ ਹਾਂ ਇਹ ਹੌਲੀ ਹੌਲੀ ਆਪਣੇ ਪੈਰ ਜਮਾਉਂਦਾ ਮੇਲਿਆਂ 'ਤੇ ਜ ਭੰਗੜੇ ਭੰਗੜੇ ਜਿਹਾ ਪਾਉਂਦੇ ਜੱਟ ਜਦੋਂ ਹਾੜੀ ਵੱਢ ਕੇ ਕੋਈ ਆਪਣਾ ਮੇਲਿਆਂ 'ਤੇ ਜਾਂਦੇ ਤਾਂ ਉੱਥੇ ਭੰਗੜੇ ਭੰਗੜੇ ਪੋ ਪਾਉਂਦੇ ਹੋਰ ਸੱਭਿਆਚਾਰ ਵਿੱਚ ਇਸ ਦੇ ਮਹੱਤਵਪੂਰਨ ਇੱਕ ਹੈ ਹੌਲੀ ਹੌਲੀ ਇਹ ਇੱਕ ਤਿਉਹਾਰਾਂ ਦਾ ਮਹੱਤਵਪੂਰਨ ਹਿੱਸਾ ਬਣ ਗਿਆ ਜਿਵੇਂ ਕਿਤੇ ਵੀ ਕੋਈ ਮੇਲਾ ਹੋ ਮੇਲਾ ਹੈਗਾ ਤਿਉਹਾਰ ਮਨਾਇਆ ਜਾਂਦਾ ਹੈ ਤਾਂ ਉਹ ਢੋਲ ਤੋਂ ਬਿਨਾਂ ਤਿਉਹਾਰ ਵੀ ਅਧੂਰਾ ਮੰਨਿਆ ਜਾਂਦਾ ਹ ਮੰਨਿਆ ਜਾਂਦਾ ਹੈ ਜਦੋਂ ਢੋਲ ਵੱਜਦਾ ਹੈ ਅਤੇ ਆਟੋਮੈਟਿਕ ਹੀ ਇਹਦੇ ਉੱਤੇ ਪੈਰ ਥਿਰ ਥਿਰਕਦੇ ਆ ਪੰਜਾਬੀ ਹੌਲੀ ਹੌਲੀ ਇਹ ਇੱਕ ਤਿਉਹਾਰਾਂ ਦਾ ਮਹੱਤਵਪੂਰਨ ਹਿੱਸਾ ਬਣ ਬਣ ਗਿਆ ਬਣਿਆ ਜਾਂਦਾ ਬਣ ਰਿਹਾ ਹੈ ਕਿਉਂਕਿ ਇਸ ਤੋਂ ਬਿਨਾਂ ਕੋਈ ਵੀ ਜਸ਼ਨ ਹੈ ਉਹ ਅਧੂਰਾ ਮੰਨਿਆ ਜਾਂਦਾ ਹੈ ਅਧੂਰਾ ਮੰਨਣ ਦੇ ਭਾਵ ਨਾਲ ਵੀ ਹਰੇਕ ਖੁਸ਼ੀ ਦੇ ਮੌਕੇ ਭੰਗੜੇ ਪਾਏ ਜਾਂਦੇ ਨੇ ਹਰੇਕ ਤਿਉਹਾਰ ਦੇ ਮੌਕੇ ਭੰਗੜੇ ਪਾਏ ਜਾਂਦੇ ਨੇ ਤਾਂ ਕਿ ਭੰਗੜੇ ਦੇ ਇੱਕ ਖੁਸ਼ੀ ਦੀ ਲਹਿਰ ਪੈਦਾ ਹੁੰਦੀ ਹੈ ਇਸ ਲਈ ਇਹ ਜੋ ਵੀ ਭੰਗੜ ਭੰਗੜਾ ਹੌਲੀ ਹੌਲੀ ਤਿਉਹਾਰਾਂ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਬਣਦਾ ਜਾ ਰਿਹਾ ਹੈ ਅਤੇ ਇਸ ਨੂੰ ਬਹੁਤ ਬਹੁਤ ਸਾਰੇ ਕਲਾਕਾਰਾਂ ਨੇ ਆਪਣੀ ਜੁੰਡਲੀ ਬਣਾ ਕੇ ਵੀ ਇੱਕ ਪ੍ਰਚਲਿਤ ਕੀਤਾ ਜਿਸ ਨੂੰ ਹਰੇਕ ਤਿਉਹਾਰ 'ਤੇ ਉਹ ਆਪਣਾ ਜਿਵੇਂ ਵਿਸਾਖੀ ਹੋਇਆ ਦਿਵਾਲੀ ਹੋਈ ਲੋਹੜੀ ਹੋਈ ਹਰੇਕ ਆਪਣਾ ਲੋਹੜੀ ਦੇ ਤਿਉਹਾਰ 'ਤੇ ਇਹਨੂੰ ਬਹੁਤ ਵੀ ਮੰਨਿਆ ਜਾਂਦਾ ਇਸ ਤੋਂ ਬਿਨਾਂ ਲੋਹੜੀ ਅਧੂਰੀ ਮੰਨੀ ਜਾਂਦੀ ਹੈ ਅਤੇ ਹੋਰ ਵੀ ਇਸ ਤਰ੍ਹਾਂ ਦਾ ਵੀ ਜੋ ਜੋ ਹੌਲੀ ਹੌਲੀ ਇਹ ਹੌਲੀ ਹੌਲੀ ਤਿਉਹਾਰ ਦਾ ਇੱਕ ਮਹੱਤਵਪੂਰਨ ਹਿੱਸਾ ਦਾ ਬਣ ਰਿਹਾ ਹੈ ਪੰਜਾਬੀ ਸੱਭਿਆਚਾਰ ਵਿੱਚ ਭੰਗੜੇ ਦੀ ਵਿਸ਼ੇਸ਼ ਸਥਾਨ ਹੈ ਇਸ ਤੋਂ ਬਿਨਾਂ ਵਾਵਾ ਵੀ